ਸਾਡਾ ਇੱਕ ਛੋਟਾ ਜਿਹਾ ਪਰਿਵਾਰ ਹੈ ਜਿਸਦੇ ਵਿੱਚ ਇੱਕ ਮੇਰੇ ਮਾਤਾ ਪਿਤਾ ਅਤੇ ਮੇਰਾ ਭਰਾ ਅਤੇ ਮੇਰੀ ਇੱਕ ਭੈਣ ਜੋ ਕਿ ਮੇਰੀ ਵੱਡੀ ਭੈਣ ਉਹਦਾ ਵਿਆਹ ਹੋ ਚੁੱਕਿਆ ਹੈ ਅਤੇ ਅਸੀਂ ਛੋਟੇ ਜਿਹੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਨ ਅਸੀਂ ਹਮੇਸ਼ਾ ਇਕੱਠੇ ਮਿਲ ਕੇ ਰਹਿੰਦੇ ਹਨ ਅਤੇ ਕਿਤੇ ਵੀ ਜਾਣਾ ਹੁੰਦਾ ਅਤੇ ਅਸੀਂ ਸਾਰੇ ਪਰਿਵਾਰ ਮਿਲ ਕੇ ਇਕੱਠੇ ਜਾਂਦੇ ਹਨ ਅਤੇ ਸਾਡੇ ਕੋਲ਼ ਸਾਰੇ ਪਰਿਵਾਰ ਦੇ ਕੋਲ਼ ਸਿਰਫ ਇੱਕ ਰਾਤ ਨੂੰ ਟਾਈਮ ਹੁੰਦਾ ਜਦੋਂ ਅਸੀਂ ਇਕੱਠੇ ਬੈਠਦੇ ਹਾਂ ਅਤੇ ਰੋਟੀ ਖਾਂਦੇ ਹਾਂ ਕਿਉਂਕਿ ਦਿਨਾਂ ਦੇ ਵਿੱਚ ਸਾਰੇ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੁੰਦੇ ਹਨ ਅਤੇ ਅਸੀਂ ਇੱਕ ਦੂਜੇ ਨੂੰ ਜਿਆਦਾ ਟਾਈਮ ਨਹੀਂ ਦੇ ਪਾਂਦੇ ਰਹੀ ਗੱਲ ਦੋਸਤਾਂ ਦੀ ਦੋਸਤਾਂ ਦੇ ਨਾਲ਼ ਮਿਲਣ ਲਈ ਜ਼ਿਆਦਾ ਵਾਧੂ ਟਾਈਮ ਤਾਂ ਨਹੀਂ ਹੁੰਦਾ ਬਟ ਜਦੋਂ ਵੀ ਟਾਈਮ ਮਿਲਦਾ ਹੈ ਤਾਂ ਉਹ ਵੀ ਅਸੀਂ ਕਦੇ ਹਫਤੇ ਬਾਅਦ ਜਾਂ ਮਹੀਨੇ ਜਾਂ ਦੋ ਤਿੰਨ ਮਹੀਨੇ ਬਾਅਦ ਹੀ ਅਸੀਂ ਉਹਨਾਂ ਨੂੰ ਮਿਲ ਪਾਂਦੇ ਹਨ ਅਤੇ ਜਿਵੇਂ ਮੇਰੇ ਦੋਸਤ ਨੂੰ ਬਹੁਤ ਹੀ ਵਧੀਆ ਹਨ ਕਿ ਹਰ ਮੁਸ਼ਕਿਲ ਦੇ ਵਿੱਚ ਮੇਰੇ ਨਾਲ਼ ਖੜ੍ਹੇ ਹੁੰਦੇ ਹਨ ਕਿ ਜਿਹੜੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਆ ਮੈਂ ਆਪਣੀ ਪ੍ਰੋਬਲਮ ਉਹਨਾਂ ਨਾਲ਼ ਸ਼ੇਅਰ ਕਰ ਸਕਦੀ ਹਾਂ